ਜੀ ਹਾਂ ਮੈਂ ਆਪਣੇ ਸਾਥੀ ਨਾਲ ਯੋਗਾ ਕੀਤਾ ਹੈ ਇਹ ਅਨੁਭਵ ਬਹੁਤ ਵਧੀਆ ਰਿਹਾ ਕਿਉਂਕਿ ਕੋਈ ਵੀ ਚੀਜ਼ ਜਦੋਂ ਅਸੀਂ ਇਕੱਲੇ ਕਰਦੇ ਹਾਂ ਜਾਂ ਕਿਸੇ ਨਾਲ ਮਿਲ ਕੇ ਕਰਦੇ ਹਾਂ ਤਾਂ ਉਹਦਾ ਅਨੁਭਵ ਅਲੱਗ ਹੁੰਦਾ ਹੈ ਕਿਸੇ ਨਾਲ ਮਿਲ ਕੇ ਕਰਨ ਵਿੱਚ ਸਾਨੂੰ ਦੂਸਰੇ ਸਾਥੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਸਮੂਹ ਵਿੱਚ ਅਸੀਂ ਬਹੁਤ ਕੁਛ ਨਵਾਂ ਸਿੱਖਦੇ ਹਾਂ ਜਿਸ ਦੇ ਨਾਲ ਮੇਰਾ ਇਹ ਅਨੁਭਵ ਬਹੁਤ ਵਧੀਆ ਰਿਹਾ ਅਤੇ ਮੈਨੂੰ ਕੁਝ ਨਵਾਂ ਸਿੱਖਣ ਨੂੰ ਮਿਲਿਆ ਅਤੇ ਕੁਝ ਉਨ੍ਹਾਂ ਨੇ ਵੀ ਮੇਰੇ ਤੋਂ ਸਿੱਖਿਆ ਅਤੇ ਸਾਨੂੰ ਇਕੱਠੇ ਯੋਗਾ ਕਰਨ ਵਿੱਚ ਬਹੁਤ ਵਧੀਆ ਲੱਗਿਆ